ਜਦੋਂ ਲੋਕ ਸੈਰ ਸਪਾਟਾ ਕਰਨ ਲਈ ਕਿਸੀ ਦੂਸਰੀਆਂ ਥਾਵਾਂ 'ਤੇ ਜਾਂਦੇ ਹੈ ਤਾਂ ਜਿਹੜੇ ਉੱਥੋਂ ਦੇ ਸਥਾਨਕ ਕਾਰੋਬਾਰੀ ਹੁੰਦੇ ਹੈ ਤਾਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਵਿੱਚ ਵਾਧਾ ਕਰਨ ਵਿੱਚ ਬਹੁਤ ਸਹਾਇਤਾ ਹੁੰਦੀ ਹੈ ਕਿਉਂਕਿ ਜਿਹੜੀਆਂ ਉਹ ਦੁਕਾਨਾਂ ਕੁਛ ਵੀ ਖਾਣ ਪੀਣ ਅਤੇ ਹੋਰ ਪਹਿਨਣ ਕੱਪੜੇ ਪਹਿਨਣ ਹੋਰ ਚੀਜ਼ਾਂ ਦੀਆਂ ਲਗਾਉਂਦੇ ਹਨ ਤਾਂ ਜਦੋਂ ਲੋਕ ਬਾਹਰ ਤੋਂ ਆ ਕੇ ਉੱਥੇ ਖਰੀਦਦਾਰੀ ਕਰਦੇ ਹਨ ਤਾਂ ਉਨ੍ਹਾਂ ਦੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ